ਮੈਂ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਰੱਖਦੀ ਹਾਂ ਅਤੇ ਮੇਰੀਆਂ ਕੁਛ ਥਾਵਾਂ ਹਨ ਜੋ ਮੈਨੂੰ ਬਹੁਤ ਤਰੋਤਾਜ਼ਾ ਕਰ ਦਿੰਦੀਆਂ ਹਨ ਜਿਵੇਂ ਕਿ ਸਤਾਰ੍ਹਾਂ ਸੈਕਟਰ ਦੀ ਮਾਰਕੀਟ ਸੁਖਨਾ ਝੀਲ ਮਨਾਲੀ ਮਨਾਲੀ ਦੀ ਆਬਾਦੀਆਂ ਬਹੁਤ ਸੋਹਣੀਆਂ ਹਨ ਜੋ ਕਿ ਸਾਨੂੰ ਤਰੋਤਾਜ਼ਾ ਕਰ ਦਿੰਦੀਆਂ ਹਨ ਇੱਦਾਂ ਹੀ ਮੈਂ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਵੀ ਘੁੰਮਣਾ ਫਿਰਨਾ ਬਹੁਤ ਪਸੰਦ ਕਰਦੀ ਹਾਂ ਅਤੇ ਮੈਂ ਇਹਨਾਂ ਥਾਵਾਂ 'ਤੇ ਜਾਂਦੀ ਰਹਿੰਦੀ ਹਾਂ